ਭੰਗੜੇ ਦੇ ਕੁਛ ਆਮ ਸਟੈਪ ਜਿਵੇਂ ਕਿ ਭੰ ਲੁੱਡੀ ਜੁੱਤੀ ਧਮਾਲ ਝੂਮਰ ਆਦੀ ਹਨ ਅਤੇ ਇਸ ਤਰਾਂ ਉਹ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਬੜਾ ਯੋਗਦਾਨ ਪਾਉਂਦਾ ਹੈ ਕਿਉਂਕਿ ਭੰਗੜੇ ਨੂੰ ਪੂਰੇ ਜੋਸ਼ ਅਤੇ ਹੋਸ਼ ਖੁਲਾਸ ਦੇ ਨਾਲ ਪਾਇਆ ਜਾਂਦਾ ਹੈ ਅਸੀਂ ਕੋਈ ਵੀ ਫੰਕਸ਼ਨ ਭੰਗੜੇ ਗਿੱਦੇ ਤੋਂ ਬਿਨਾਂ ਸੰਪੂਰਨ ਮੰਨੀ ਮੰਨਿਆ ਜਾਂਦਾ ਸੋ ਇਹ ਪੰਜਾਬੀ ਸੱਭਿਆਚਾਰ ਦੇ ਜਸ਼ਨ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ